ਸਾਡੇ ਪੰਜਾਬ ਵਿੱਚ ਪ੍ਰਸਿੱਧ ਮੰਨੋਰੰਜਨ ਗਤੀਵਿਧੀਆਂ ਜਾਂ ਸਾਹਸੀ ਖੇਡਾਂ ਖਿਡਾਈਆਂ ਜਾਂਦੀਆਂ ਹਨ ਜੇਕਰ ਗੱਲ ਕਰੀਏ ਦਾ ਵਾਟਰ ਪਾਰਕ ਦੀ ਸਾਡੇ ਪਿੰਡ ਦੇ ਕੋਲ ਇੱਕ ਸ਼ਹਿਰ ਹੈ ਜਿੱਥੇ ਵਾਟਰ ਪਾਰਕ ਬਣਿਆ ਹੋਇਆ ਹੈ ਲੋਕ ਉੱਥੇ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਜਾਂਦੇ ਹਨ ਅਤੇ ਉੱਥੇ ਕਈ ਤਰ੍ਹਾਂ ਦੇ ਝੂਲੇ ਲੱਗੇ ਹਨ ਜੋ ਕਿ ਵਾ ਪਾਣੀ ਵਿੱਚ ਜਾ ਕੇ ਹੀ ਜਿਨ੍ਹਾਂ ਦਾ ਆਨੰਦ ਲਿਆ ਜਾ ਸਕਦਾ ਹੈ ਉੱਥੇ ਬੱਚਿਆਂ ਨੂੰ ਪਾਣੀ ਵਿੱਚ ਤੈਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਦੇ ਦਿੱਤੀ ਜਾਂਦੀ ਹੈ ਅਤੇ ਕਈ ਬੱਚ ਕਈ ਬੱਚੇ ਉੱਥੇ ਜਾਣਾ ਬਹੁਤ ਪਸੰਦ ਕਰਦੇ ਹਨ ਆਪਣੇ ਘਰਦਿਆਂ ਨਾਲ